ਮੈਂ ਸਵੀਗੀ ਤੋਂ ਔਪੋ ਦਾ ਫੋਨ ਆਰਡਰ ਕੀਤਾ ਸੀ ਜੋ ਕਿ ਬਹੁਤ ਹੀ ਰਿਆਇਤ ਵਿੱਚ ਮਿਲ ਗਿਆ ਅਤੇ ਇਸ ਵਿੱਚ ਫੀਚਰਸ ਵੀ ਬਹੁਤ ਜ਼ਿਆਦਾ ਹਨ ਮੈਂ ਪਹਿਲਾਂ ਇੱਕ ਫੋਨ ਦੁਕਾਨ ਤੋਂ ਹੀ ਖਰੀਦਿਆ ਸੀ ਪਰ ਉਹ ਮੈਨੂੰ ਬਹੁਤ ਮਹਿੰਗਾ ਲੱਗਾ ਜਦੋਂ ਕਿ ਔਨਲਾਈਨ ਫੋਨ ਸਸਤਾ ਅਤੇ ਮਿਲਿਆ ਹੀ ਅਤੇ ਟਾਈਮ 'ਤੇ ਵੀ ਪਹੁੰਚ ਗਿਆ ਜਦੋਂ ਇਹ ਮੈਨੂੰ ਡਿਲੀਵਰੀ ਟਾਈਮ ਦਿਖਾ ਰਿਹਾ ਸੀ ਉਸ ਤੋਂ ਵੀ ਪਹਿਲਾਂ ਮੇਰੇ ਘਰ ਪਹੁੰਚ ਗਿਆ ਉਸਦਾ ਰੰਗ ਵੀ ਮੈਨੂੰ ਬਹੁਤ ਪਸੰਦ ਆਇਆ ਇਸਦੇ ਸਾਰੇ ਹੀ ਫੀਚਰਸ ਬਹੁਤ ਵਧੀਆ ਹਨ ਹੈ ਵੀ ਇਹ ਫਾਈਵ ਜੀ ਜੋ ਕਿ ਮੈਨੂੰ ਚਾਹੀਦਾ ਸੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਇਹ ਸਸਤੇ ਵਿੱਚ ਹੀ ਮਿਲ ਗਿਆ